ਬੀਮਾ ਸਾਨੂੰ ਸਾਰਿਆਂ ਨੂੰ ਕਰਾਉਣਾ ਚਾਹੀਦਾ ਹੈ ਸਾਡੇ ਆਉਣ ਵਾਲੇ ਭਵਿੱਖ ਵਾਸਤੇ ਬੱਚਿਆਂ ਵਾਸਤੇ ਸਾਨੂੰ ਬੀਮਾ ਕਰਨਾ ਚਾਹੀਦਾ ਵਾ ਕਿ ਬੀਮੇ ਦੇ ਬਹੁਤ ਫਾਇਦੇ ਹੁੰਦੇ ਹਨ ਅਤੇ ਉਹ ਸਾਡੇ ਬਦਲ ਸਕਦੇ ਆ ਆਪਣੀ ਨੀਮਾ ਨਿਯਮ ਕਾਇਦੇ ਕਿ ਉਹਨਾਂ ਨੂੰ ਮਤਲਬ ਬੈਂਕ ਵਾਲਿਆਂ ਨੂੰ ਕੁਛ ਕਰਨਾ ਚਾਹੀਦਾ ਵਾ ਸਾਡੇ ਵਾਸਤੇ ਬੈਂਕ ਦੇ ਨਿਯਮ ਅਤੇ ਜਿਹਨਾਂ ਨਾਲ ਅਸੀਂ ਆਪਣਾ ਬੀਮਾ ਕਰਵਾ ਸਕੀਏ ਅਤੇ ਵਧੀਆ ਤਰੀਕੇ ਨਾਲ ਬੈਂਕ ਦੇ ਕਰਮਚਾਰੀਆਂ ਨੂੰ ਗੱਲਬਾਤ ਕਰਨੀ ਚਾਹੀਦੀ ਹੈ ਸਮਝਾਉਣਾ ਚਾਹੀਦਾ ਵਾ ਅਤੇ ਸਾਨੂੰ ਵੀ ਮਤਲਬ ਵਧੀਆ ਤਰੀਕੇ ਨਾਲ ਉਹਨਾਂ ਦੀਆਂ ਕਿਸ਼ਤਾਂ ਲੋਨ ਮਤਲਬ ਜੋ ਵੀ ਆ ਕਿਸ਼ਤ ਦੇਣੀ ਚਾਹੀਦੀ ਆ ਅਤੇ ਸਾਨੂੰ ਬਿਹਤਰ ਹੋਣ ਦਾ ਮੌਕਾ ਦਿਓ ਬੈਂਕਾਂ ਨੂੰ ਚਾਹੀਦਾ ਵਾ ਕਿ ਉਹ ਆਪਣੇ ਬੀਮਿਆਂ 'ਚ ਵੀ ਪਰਿਵਰਤਨ ਕਰਨ ਅਤੇ ਵਧੀਆ ਤਰੀਕੇ ਨਾਲ ਸਾਰਿਆਂ ਨੂੰ ਦੇਣ ਆਸ਼ਾ ਕਰਦੇ ਹੈਗੇ